ਹਾਂਜੀ ਹੈਂਡ ਪੰਪ ਹੈਂਡ ਪੰਪ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਨਲਕਾ ਕਹਿੰਦੇ ਹੈ ਜਿਹਦੀ ਹੱਥੀ ਦੇ ਨਾਲ ਅਸੀਂ ਪਾਣੀ ਜਦੋਂ ਹੱਥੀ ਨੂੰ ਗੇੜਦੇ ਐਂ ਤਾਂ ਪਾਈਪ ਰਾਹੀਂ ਜਿਹੜਾ ਪਾਣੀ ਆਉਂਦਾ ਹੈ ਇਹ ਪਾਣੀ ਮਤਲਬ ਕਿ ਇਹ ਪਾਣੀ ਨਾਲ ਜਿਹੜੀ ਹੌਲੀ ਹੌਲੀ ਬਾਲਟੀ ਭਰਦੀ ਹੈ ਕਿਉਂਕਿ ਇਹ ਪਾਣੀ ਦਾ ਜਿਹੜਾ ਬਹੁਤ ਘੱਟ ਆਉਂਦਾ ਹੈ ਪਾਣੀ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਇਹ ਹੈਂਡ ਪੰਪ ਆ ਉਹ ਜ਼ਿਆਦਾ ਵਰਤੇ ਜਾਂਦੇ ਸੀਗੇ ਲੋਕਾਂ ਦੇ ਕੋਲ ਜਿਹੜੀਆਂ ਮੋਟਰਾਂ ਹੈ ਉਹਨਾਂ ਦਾ ਓ ਉਹ ਸੋਰਸ ਬਹੁਤ ਘੱਟ ਸੀਗੇ ਲੋਕ ਹੈ ਜਿਹੜੇ ਪਾਣੀ ਲਈ ਖੂਹਾਂ ਹੈਂਡ ਪੰਪਾਂ ਇਹਨਾਂ 'ਤੇ ਜਿਹੜੇ ਡਿਪੈਂਡ ਹੁੰਦੇ ਸੀਗੇ ਇਹਨਾਂ ਤੋਂ ਜਿਹੜਾ ਉਹ ਪਾਣੀ ਲਈ ਕੀ ਹੁੰਦਾ ਸੀ ਜਿੱਥੇ ਪਾਣੀ ਚੰਗਾ ਹੁੰਦਾ ਸੀਗਾ ਜ਼ਿਆਦਾ ਵਧੀਆ ਹੁੰਦਾ ਸੀ ਪੀਣ ਯੋਗ ਹੁੰਦਾ ਸੀ ਉੱਥੇ ਲੋਕ ਲਾਈਨਾਂ ਦੇ ਵਿੱਚ ਜਿਹੜੀ ਪਾਣੀ ਨੂੰ ਲੈਣ ਜਾਂਦੇ ਸੀਗੇ ਜਿਹਦੀ ਵੀ ਵਾਰੀ ਆਉਂਦੀ ਸੀ ਉਹ ਆਪਣੀ ਬਾਲਟੀ ਨੂੰ ਭਰਦਾ ਸੀ ਹੈਂਡ ਪੰਪ ਦੇ ਵਿੱਚ ਕੀ ਸਭ ਤੋਂ ਵੱਡੀ ਕੀ ਹੈ ਸਭ ਤੋਂ ਮਤਲਬ ਕਿ ਔਖਾ ਇਹਨੂੰ ਗੇੜਨਾ ਪੁਰਾਣੇ ਟਾਈਮਾਂ ਦੇ ਵਿੱਚ ਪਾਣੀ ਦੀ ਘਾਟ ਕਰਕੇ ਹੈਂਡ ਪੰਪ ਜ਼ਿਆਦਾ ਜਿਹੜੇ ਯੂਜ ਕੀਤੇ ਜਾਂਦੇ ਸੀਗੇ ਅਤੇ ਗਰਮੀਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਪਾਣੀ ਦਾ ਸਤਰ ਹੈ ਜਿਹੜਾ ਉਹ ਡੂੰਘਾ ਚਲਿਆ ਜਾਂਦਾ ਸੀ ਤਾਂ ਹੈਂਡ ਪੰਪ ਦੇ ਵਿੱਚੋਂ ਪਾਣੀ ਘੱਟ ਜਾਂਦਾ ਸੀਗਾ ਪੰਜਾਬ ਦੇ ਵਿੱਚ ਵੀ ਕਈ ਅਜਿਹੀਆਂ ਜਗ੍ਹਾ ਹੈਗੀਆਂ ਹੈ ਜਿੱਥੇ ਪਾਣੀ ਦਾ ਸਤਰ ਨੀਚੇ ਚਲਿਆ ਗਿਆ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹੈਂਡ ਪੰਪ ਆ ਉਹ ਬਹੁਤ ਘੱਟ ਦੇਖਣ ਨੂੰ ਮਿਲਦੇ ਹੈ ਮੈਂ ਵੀ ਇਹ ਜਿਹੜਾ ਹੈਂਡ ਪੰਪ ਆ ਅਪ ਆਪ ਗੇੜ ਕੇ ਦੇਖਿਆ ਹੋਇਆ